ਮੈਂ ਫਤਿਹਗੜ੍ਹ ਸਾਹਿਬ ਡਾਂਸ ਗਰੁੱਪ ਵਿੱਚ ਭੰਗੜਾ ਸਿੱਖ ਰਿਹਾ ਸੀ ਅਤੇ ਇਹ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਆ ਜੀ ਇਹਨਾਂ ਦਾ ਬਹੁਤ ਵਧੀਆ ਸਿਖਾਉਣ ਦਾ ਢੰਗ ਬਹੁਤ ਵਧੀਆ ਜੀ ਅਤੇ ਬਹੁਤ ਵਧੀਆ ਇਹਨਾਂ ਨੇ ਫਤਿਹਗੜ੍ਹ ਜ਼ਿਲ੍ਹੇ ਦਾ ਨਾਂ ਵੀ ਰੋਸ਼ਨ ਕੀਤਾ ਹੈ ਬਾਹਰ ਜਾ ਕੇ ਸਿੱਖਿਆ ਬਾਹਰ ਜਾ ਕੇ ਭੰਗੜਾ ਪਾਉਂਦੇ ਹੈ ਅਤੇ ਬਹੁਤ ਨਾਂ ਰੋਸ਼ਨ ਕਰਕੇ ਅਤੇ ਇਹਨਾਂ ਮੈਨੂੰ ਇਹਨਾਂ ਕੋਲ ਮੈਂ ਬਹੁਤ ਬੰਦੇ ਭੇਜੇ ਸਿੱਖਣ ਵਾਸਤੇ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਆ ਜੀ ਅਤੇ ਆਪਣੇ ਬੱਚਿਆਂ ਨੂੰ ਮੈਂ ਕਹਾਂ ਇਹਨਾਂ ਕੋਲ ਡਾਂਸ ਸਿੱਖਣ ਵਾਸਤੇ ਭੇਜਿਆ ਜੀ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਆ ਜੀ